ਹੈਲੋ ਓਲਾ ਤੋਂ ਬੋਲਦੇ ਹੋ ਅੱਛਾ ਇਸ ਤਰ੍ਹਾਂ ਸੀ ਮੈਂ ਟੈਕਸੀ ਬੁਲਾਈ ਸੀ ਉਹਨੂੰ ਕਿਹਾ ਸੀ ਮੈਂ ਸਾਢੇ ਨੌੌੌਂ ਵਜੇ ਐਗਜੈਕਟ ਪਹੁੰਚ ਜਾਵੇ ਜਦੋਂ ਕਿ ਤੁਹਾਡਾ ਜਿਹੜਾ ਟੈਕਸੀ ਵਾਲਾ ਮੇਰੇ ਕੋਲ ਦਸ ਵਜੇ ਤੋਂ ਵੀ ਬਾਅਦ ਆਇਆ ਔਰ ਜਿਸ ਕਰਕੇ ਮੇਰੀ ਟਰੇਨ ਜਿਹੜੀ ਹੈ ਉਹ ਮਿਸ ਹੋ ਗਈ ਮੈਂ ਬੜੇ ਜ਼ਰੂਰੀ ਕੰਮ ਲਈ ਇੰਟਰਵਿਊ ਦੇਣ ਲਈ ਜਾਣਾ ਸੀ ਦਿੱਲੀ ਔਰ ਜਿਹਦੇ ਕਰਕੇ ਮੈਨੂੰ ਬੱਸ ਫੜਨੀ ਪਈ ਔਰ ਐਕਸਟਰਾ ਜਿਹੜਾ ਐਕਸਪੈਂਸ ਵੀ ਕਰਨਾ ਪਿਆ ਔਰ ਇਸ ਕਰਕੇ ਤੁਸੀਂ ਇਸ ਆਪਣੇ ਡਰਾਈਵਰ ਨੂੰ ਇੱਕ ਵਾਰੀ ਤਾਂ ਪੁੱਛੋ ਵੀ ਇਹਨੇ ਇਸ ਤਰ੍ਹਾਂ ਕਿਉਂ ਕੀਤਾ ਜਦ ਮੈਂ ਟਾਈਮ ਐਗਜੈਕਟ ਦਿੱਤਾ ਸੀ ਉਹ ਟਾਈਮ ਸਿਰ ਕਿਉਂ ਨਹੀਂ ਪਹੁੰਚਿਆ ਅਤੇ ਇਸ ਗੱਲ ਦਾ ਮੈਨੂੰ ਹਰਜ਼ਾਨਾ ਦਿੱਤਾ ਜਾਵੇ ਅਤੇ ਬਸ ਫਿਰ ਰਿਫੰਡ ਕੀਤਾ ਜਾਵੇ